ਗੁੱਡ ਮੋਰਨਿੰਗ ਜੀ ਫਿਰ ਤੁਸੀਂ ਕਾਹਦੇ ਟੀਚਰ ਹੋਏ ਤੁਸੀਂ ਹੈਂਡਲ ਕਰਨਾ ਨਾ ਬੱਚਿਆਂ ਨੂੰ ਪਰ ਤੁਸੀਂ ਕੋਸ਼ਿਸ਼ ਕਰੋ ਨਾ ਵੀ ਉਹਨਾਂ ਨੂੰ ਇਹ ਟੀਚਰ ਦਾ ਫਰਜ ਹੁੰਦਾ ਨਾ ਬੱਚਿਆਂ ਨੂੰ ਹੈਂਡਲ ਕਰਨਾ ਕਿਸੇ ਵੀ ਤਰੀਕੇ ਨਾਲ ਇਸ ਤਰ੍ਹਾਂ ਕ ਕੋਈ ਜਿਸ ਤਰ੍ਹਾਂ ਕੋਈ ਪ ਪੁਨਿਸ਼ਮੈਂਟ ਕੋਈ ਕਿਸ ਤਰ੍ਹਾਂ ਕੋਈ ਦਿਓ ਉਹਨਾਂ ਨੂੰ ਫਿਰ ਤੁਸੀਂ ਕੋਈ ਨਾ ਕੋਈ ਸਲਿਊਸ਼ਨ ਹੈ ਲੱਭੋ ਕਿ ਜਿਵੇਂ ਕੋਈ ਅ ਖੇਡਣ ਦੀ ਐਕਟੀਵੀਟੀ ਦੇ ਨਾਲ ਕੋਈ ਕਰਾਓ ਕੋਈ ਮਤਲਬ ਕਿ ਜਿਵੇਂ ਸਮਾਰਟ ਕਲਾਸ ਦੇ ਹਿਸਾਬ ਨਾਲ ਤੁਸੀਂ ਉਸ ਤਰਾਂ ਕੰਮ ਕਰਾਓ ਕਿ ਬੱਚੇ ਥੋੜ੍ਹਾ ਇੰਨਜੋਆਏ ਫੀਲ ਕਰਨ ਅਤੇ ਕੰਮ ਵੀ ਕਰ ਲੈਣ ਜਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਇਹਨਾਂ ਦੇ ਪੇਰੈਂਟਸ ਨੂੰ ਬੁਲਾਓ ਅਤੇ ਪੇਰੈਂਟਸ ਦੇ ਨਾਲ ਤੁਸੀਂ ਮੇਰੇ ਨਾਲ ਇੱਕ ਵਾਰੀ ਮਿਲਾਓ ਅਤੇ ਫਿਰ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਮਤਲਬ ਕਿ ਕਰਨਾ ਵਾ ਵੀ ਥੋੜ੍ਹਾ ਜਿਹਾ ਕ ਕਲਾਸ ਵਿੱਚ ਕੰਟਰੋਲ ਵਿੱਚ ਰਹਿਣ ਤੁਸੀਂ ਇੱਕ ਵਾਰ ਮੇਰੇ ਨਾਲ ਉਹਨਾਂ ਨੂੰ ਆਹਮੋ ਸਾਹਮਣੇ ਕਰਾਉਣਾ ਔਰ ਇਸ ਤੋਂ ਇਲਾਵਾ ਕੋਈ ਪ੍ਰੋਬਲਮ ਅੱਛਾ ਹਾਂ ਹਾਂ ਉਹਨਾਂ ਨੂੰ ਲਿਆਓ ਮੇਰੇ ਕੋਲ ਪੇਰੈਂਟਸ ਨੂੰ ਅਤੇ ਫਿਰ ਉਹਨਾਂ ਨਾਲ ਅਸੀਂ ਕਰਦੇ ਹਾਂ ਵੀ ਇਹਨਾਂ ਦੀ ਥੋੜ੍ਹਾ ਜਿਹਾ ਕਰੋ ਇਹਨਾਂ ਵੱਲ ਧਿਆਨ ਦਿਓ ਉਚੇਚਾ ਧਿਆਨ ਦਿਓ ਇਹ ਪੇਰੈਂਟਸ ਵੀ ਥੋੜ੍ਹੇ ਅੱਜ ਕੱਲ੍ਹ ਨਹੀਂ ਕਰ ਰਹੇ ਧਿਆਨ ਪਰ ਤੁਸੀਂ ਵੀ ਆਪਣਾ ਕੋਸ਼ਿਸ਼ ਕਰੋ ਕਿ ਹੋਰ ਥੋੜ੍ਹਾ ਜਿਹਾ ਇਹਨਾਂ ਨੂੰ ਤਰੀਕੇ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਸੈੱਟਅੱਪ ਕਰਨਾ ਵਾ ਹਾਂਜੀ ਅਤੇ ਹੋਰ ਤੁਸੀਂ ਮੈਂ ਨਾ ਇੱਕ ਤੁਹਨੂੰ ਕੰਮ ਕਹਿਣਾ ਸੀ ਕਿ ਐਕਟੀਵੀਟੀਜ਼ ਨਾ ਫੰਕਸ਼ਨ ਹੋਣਾ ਵਾ ਸਕੂਲ ਦੇ ਵਿੱਚ ਚੌਦਾਂ ਨਵੰਬਰ ਦਾ ਸੋਰੀ ਚੌਦਾਂ ਦਾ ਨਹੀਂ ਆਪਾਂ ਕਿਹੜਾ ਕਰਨਾ ਹੁਣ ਵਿਸਾਖੀ ਦਾ ਅਤੇ ਵਿਸਾਖੀ ਦਾ ਫੰਕਸ਼ਨ ਹੋਣਾ ਵਾ ਤਾਂ ਤੁਸੀਂ ਤਿਆਰ ਕਰਵਾ ਦਉਂਗੇ ਬੱਚਿਆਂ ਨੂੰ ਅੱਛਾ ਅਤੇ ਕਿਹੜੀ ਐ ਤੁਸੀਂ ਐਕਟੀਵੀਟੀ ਕਰਾਓਗੇ ਅੱਛਾ ਉਹ ਫਿਰ ਤੁਹਨੂੰ ਨਾ ਦੇਖਣਾ ਪੈਣਾ ਜੇ ਕਿ ਜਿਵੇਂ ਛੋਟੇ ਬੱਚੇ ਹੈਗੇ ਹੈ ਉਹਨਾਂ ਲਈ ਮਤਲਬ ਕਿ ਰਾਇੰਮਸ ਵਗੈਰਾ ਉਹਦੇ 'ਤੇ ਕੋਈ ਤਿਆਰ ਕਰਵਾ ਦਿਉ ਬੱਚਿਆਂ ਨੂੰ ਠੀਕ ਹੈ ਨਾਲੇ ਸਭ ਤੋਂ ਛੋਟੇ ਬੱਚੇ ਹੈ ਅਤੇ ਜਾਂ ਉਹਨਾਂ ਦੀ ਫੈਂਸੀ ਡਰੈਸ ਵੀ ਹੋ ਸਕਦੀ ਹੈ ਬੱਚਿਆਂ ਦੀ ਅਤੇ ਤੁਸੀਂ ਤੇ ਨਾਲ ਇੱਕ ਹੋਰ ਮੈਡਮ ਲੈ ਲਉ ਜਿਹੜੇ ਹੈਗੇ ਆ ਅੰਮ੍ਰਿਤ ਅੰਮ੍ਰਿਤਾ ਹਾਂ ਚਲੋ ਰੇਖਾ ਮੈਡਮ ਕਰਾ ਲੈਂਦੇ ਚਲੋ ਰੇਖਾ ਮੈਡਮ ਨੂੰ ਲੈ ਲਉ ਠੀਕ ਹੈ ਉਹਨਾਂ ਨੂੰ ਨਾਲ ਲੈ ਲਉ ਅਤੇ ਇੱਕ ਫੈਂਸੀ ਡਰੈਸ ਕਰਾ ਦਿਉ ਬੱਚਿਆਂ ਨੂੰ ਛੋਟਿਆਂ ਨੂੰ ਅਤੇ ਹੋਰ ਉਸ ਤੋਂ ਬਾਅਦ ਤੁਸੀਂ ਭੰਗੜਾ ਵੀ ਕਿਹੜੇ ਮੈਡਮ ਤਿਆਰ ਕਰਵਾ ਸਕਦੇ ਨੇ ਅੱਛਾ ਉਹ ਕਰਾ ਦੇਣਗੇ ਅਤੇ ਚਲੋ ਫਿਰ ਉਹਨਾਂ ਨੂੰ ਕਹਿਣਾ ਮੇਰੇ ਕੋਲ ਜਰਾ ਮੈਨੂੰ ਮਿਲ ਕੇ ਜਾਣ ਜਰਾ ਅਤੇ ਫਿਰ ਉਹ ਭੰਗੜਾ ਤਿਆਰ ਕਰਵਾ ਦੇਣਗੇ ਅਤੇ ਹੋਰ ਚਲੋ ਫਿਰ ਠੀਕ ਹੈ ਬਾਕੀ ਬਾਆਦ 'ਚੋਂ ਦੇਖ ਲਾਂਗੇ ਹੋਰ ਕੋਈ ਐ ਐਨੀ ਪ੍ਰੋਬਲਮ ਹੋਵੇ ਤਾਂ ਡਿਸਕਸ਼ਨ ਕਰ ਲੈਣਾ ਠੀਕ ਹੈ ਓਕੇ ਜੀ ਠੀਕ ਹੈ ਧੰਨ